ਹਾਂ ਅਸੀਂ ਮੰਨਦੇ ਹਾਂ ਕਿ ਸਕਰੀਨਾਂ ਜ਼ਿਆਦਾ ਦੇਖਣ ਨਾਲ ਬੱਚਾ ਗੇਮਾਂ ਜ਼ਿਆਦਾ ਖੇਡਦਾ ਹੈ ਇਸ ਦੇ ਵਿੱਚ ਦੋਸ਼ ਇੱਕ ਪਾਸੇ ਦਾ ਨਹੀਂ ਪੰਜਾਬੀ ਦੇ ਵਿੱਚ ਇੱਕ ਕਹਾਵਤ ਹੈ ਕਿ ਤਾੜੀ ਇੱਕ ਹੱਥ ਨਹੀਂ ਦੋਵੇਂ ਹੱਥਾਂ ਨਾਲ ਵੱਜਦੀ ਹੈ ਅਤੇ ਬੱਚੇ ਅਤੇ ਮਾਂ ਪਿਓ ਦਾ ਬਰਾਬਰ ਦਾ ਹੀ ਕਸੂਰਵਾਰ ਹਨ ਜੰਮਦੇ ਬੱਚੇ ਨੂੰ ਹੀ ਮਾਂ ਪਿਓ ਜਿਵੇਂ ਉਹ ਰੋਂਦਾ ਹੈ ਖੇਡਦਾ ਰੋ ਰੋਂਦਾ ਹੁੰਦਾ ਹੈ ਤਾਂ ਉਸ ਦੇ ਹੱਥ ਦੇ ਵਿੱਚ ਫੋਨ ਫੜਾ ਦਿੰਦੇ ਹਨ ਅਤੇ ਫਿਰ ਉਹ ਚੁੱਪ ਕਰ ਜਾਂਦਾ ਹੈ ਅਤੇ ਇਸ ਕ ਇਸ ਤਰ੍ਹਾਂ ਉਹ ਸਕਰੀਨਾਂ ਖੇਡਣ ਲਈ ਬੱਚੇ ਨੂੰ ਬੜਾਵਾ ਦਿੰਦੇ ਆ ਅਤੇ ਬੱਚਾ ਫਿਰ ਸਕਰੀਨਾਂ ਦੇ ਵਿੱਚ ਹੀ ਮੋਬਾਈਲ ਦੇ ਵਿੱਚ ਹੀ ਰੁੱਝਿਆ ਰਹਿੰਦਾ ਹੈ ਜਿਉਂ ਜਿਉਂ ਉਸ ਦਾ ਬਚਪਨ ਤੋਂ ਵੱਡਾ ਹੁੰਦਾ ਜਾਂਦਾ ਹੈ ਤਾਂ ਉਹ ਮੋਬਾਈਲ ਅਤੇ ਸਕਰੀਨਾਂ ਦੀ ਵਰਤੋਂ ਜ਼ਿਆਦਾ ਕਰਨ ਲੱਗ ਜਾਂਦਾ ਹੈ ਅਤੇ ਜਿਸ ਕਾਰਨ ਬੱਚੇ ਦਾ ਮਾਨਸਿਕ ਅਤੇ ਸਰੀਰਿਕ ਵਿਕਾਸ ਨਹੀਂ ਹੁੰਦਾ ਅਤੇ ਜ਼ਿਆਦਾ ਸਕਰੀਨਾਂ ਦੇਖਣ ਨਾਲ ਅੱਜ ਕੱਲ੍ਹ ਬੱਚਿਆਂ ਦਾ ਕੱਦ ਵੀ ਛੋਟਾ ਹੁੰਦਾ ਜਾ ਰਿਹਾ ਹੈ ਅਤੇ ਬੱਚਿਆਂ ਨੂੰ ਖੇਡਣ ਲਈ ਪ੍ਰੇਰਿਤ ਕਰਨਾ ਚਾਹੀਦਾ ਹੈ ਕਿਉਂਕਿ ਜੋ ਅਸੀਂ ਬੱਚੇ ਨੂੰ ਸਿਖਾਉਂਦੇ ਹਾਂ ਉਹ ਸਿੱਖ ਲੈਂਦਾ ਹੈ ਅਤੇ ਸ਼ੁਰੂ ਤੋਂ ਹੀ ਉਸ ਨੂੰ ਖੇਡਾਂ ਖੇਡਣ ਵੱਲ ਪ੍ਰੇਰਿਤ ਕਰਨਾ ਚਾਹੀਦਾ ਹੈ ਅਤੇ ਜਿਵੇਂ ਸਵੇਰੇ ਸ਼ਾਮ ਮਾਂ ਪਿਓ ਸੈਰ ਕਰਦੇ ਆ ਤਾਂ ਆਪਣੇ ਬੱਚੇ ਨੂੰ ਵੀ ਨਾਲ ਲੈ ਕੇ ਜਾਵੇ ਅਤੇ ਉਸਨੂੰ ਪ੍ਰੇਰਿਤ ਕਰੇ ਅਤੇ ਉਸ ਨੂੰ ਗਰਾਊਂਡ ਦੇ ਵਿੱਚ ਲੈ ਕੇ ਜਾਵੇ ਅਤੇ ਸਰੀਰਕ ਵਰਜਿਸ਼ ਕਰਾਵੇ ਜਿਸ ਨਾਲ ਉਸਦਾ ਮਾਨਸਿਕ ਅਤੇ ਸਰੀਰਿਕ ਵਿਕਾਸ ਹੋ ਸਕੇ